ਹੈਲੋ ਹਾਂਜੀ ਕੌਣ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸ਼ਰਮਾ ਅੱਛਾ ਜੀ ਕਿਸ ਤਰ੍ਹਾਂ ਦੇ ਚਾਹੀਦੇ ਆ ਜੀ ਆਪਣੇ ਕੋਲ ਮਿਲ ਜਾਣਗੇ ਸਾਰੀ ਤਰ੍ਹਾਂ ਦੀ ਕੁਆਲਿਟੀ ਠੀਕ ਹੈ ਜੀ ਲੈ ਸ਼ੇਰਵਾਨੀ ਵਾਸਤੇ ਜੁੱਤੀ ਮਿਲ ਜੂਗੀ ਜੀ ਜੁੱਤੀ ਮਿਲ ਜੂਗੀ ਜੀ ਤੇ ਕੋਟ ਪੈੱਟ ਵਾਸਤੇ ਆਪਣੇ ਕੋਲ ਫਾਰਮਰ ਸ਼ੂਜ ਮਿਲ ਜਾਣਗੇ ਜੀ ਵਧੀਆ ਚਮੜੇ ਦੇ ਲੈਦਰ ਦੇ ਤੇ ਹਾਂਜੀ ਹਾਂ ਆਪਣੇ ਕੋਲ ਬਹੁਤ ਵਰਾਇਟੀਆਂ ਜੀ ਕੰਪਨੀਆਂ ਆਪਣੇ ਕੋਲੇ ਤੇ ਸਾਰੇ ਤਰ੍ਹਾਂ ਦੀਆਂ ਕੰਪਨੀਆਂ ਹੈਗੀਆਂ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਜਿਵੇਂ ਲਿਬਰਟੀ ਬਾਟਾ ਐਡੀਡਾਸ ਰਿਵੋਕ ਨਾਈਕੀ ਇਸ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਕੰਪਨੀ ਮਿਲ ਜਾਣਗੀਆਂ ਜੀ ਤੇ ਜੁੱਤੀਆਂ ਦੀ ਵੀ ਆਪਣੇ ਕੋਲ ਬਹੁਤ ਵਰਾਇਟੀ ਆ ਇਸ ਤਰ੍ਹਾਂ ਹਾਂ ਹਾਂ ਲੇਡੀਜ ਦੇ ਵੀ ਸੈਂਡਲ ਜੁੱਤੀ ਜਿਸ ਤਰ੍ਹਾਂ ਦੀ ਸਾਨੂੰ ਰਿਕੁਾਇਰਮੈਂਟ ਹੋਊਗੀ ਤੁਹਾਡਾ ਹਰ ਤਰਹਾਂ ਦੀ ਜਰੂਰਤ ਪੂਰੀ ਕੀਤੀ ਜਾਊਗੀ ਅੱਛਾ ਜੀ ਠੀਕ ਨਹੀਂ ਨਹੀਂ ਆਪਣੇ ਕੋਲ ਅੱਛਾ ਅੱਛਾ ਜੀ ਆਪਣੇ ਕੋਲ ਵਿਆਹ ਸ਼ਾਦੀਆਂ ਸਾਰਾ ਹੀ ਤਰ੍ਹਾਂ ਦਾ ਘਰ ਪੂਰਾ ਕਰਦੇ ਆ ਆਪਾਂ ਜੀ ਤੇ ਜੋ ਵੀ ਚੀਜ਼ ਦੀ ਤੁਹਾਨੂੰ ਫੁੱਟਵੇਅਰ ਨਾਲ ਸੰਬੰਧਿਤ ਜੋ ਵੀ ਚੀਜ਼ ਚਾਹੀਦੀ ਹੋਏਗੀ ਇਹ ਸਾਰੇ ਤਰ੍ਹਾਂ ਦੇ ਸੀਗੇ ਕੈਜੂਅਲ ਸ਼ੂਜ ਸਪੋਰਟਸ ਸ਼ੂਜ ਸੈਂਡਲ ਲੇਡੀਜ ਜੁੱਤੀ ਸਭ ਤਰ੍ਹਾਂ ਦੀ ਚੀਜ਼ ਆਪਣੇ ਕੋਲੇ ਹੈ ਜੀ ਤੇ ਥਾਨੂੰ ਵਾਜਿਬ ਰੇਟ ਤੇ ਹਰ ਇੱਕ ਚੀਜ਼ ਦਿੱਤੀ ਜਾਊਗੀ ਆਪਣੀ ਸ਼ੋਪ ਹੈਗੀ ਸਦਰ ਬਜਾਰ ਦੇ ਉੱਤੇ ਜਿਹੜਾ ਮੋਰਚਾ ਪਿੰਕੀ ਮਾਰਕੀਟ ਹ ਉੱਥੇ ਸ਼ੌਪ ਨੰਬਰ ਦਸ ਹੈ ਜੀ ਆਪਣੀ ਸ਼ੋਪ ਦਾ ਸ਼ਰਮਾ ਫੁੱਟ ਵੀਅਰ ਹਾਂਜੀ ਨਹੀਂ ਨਹੀਂ ਜੀ ਚੱਲਣ ਵਾਲੀ ਚੀਜ਼ ਦੇਵਾਂਗੇ ਵਧੀਆ ਕੁਆਲਿਟੀ ਦੀ ਚੀਜ਼ ਮਿਲੂ ਰੇਟ ਵਾਜਿਬ ਹੋਣਗੇ ਤੁਹਾਨੂੰ ਸਾਰੀ ਚੀਜ਼ ਵਧੀਆ ਦਿੱਤੀ ਜਾਊਗੀ ਜੀ ਤੁਸੀਂ ਇੱਕ ਵਾਰ ਆਓਗੇ ਤਾਂ ਬਾਰ ਬਾਰ ਇੱਥੇ ਹੀ ਆਓਗੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਹੀਂ ਆਉਗੀ ਜੀ ਸਾਡੇ ਕਿਸੀ ਚੀਜ਼ ਦੀ ਹਾਂਜੀ ਹਾਂਜੀ ਬੱਚਿਆਂ ਦੇ ਵੀ ਬੱਚਿਆਂ ਦੇ ਵੀ ਹਰ ਇੱਕ ਤਰ੍ਹਾਂ ਦੀ ਵਰਾਈਟੀ ਆਪਣੇ ਕੋਲੇ ਅਵੇਲੇਬਲ ਹ ਜਿਸ ਤਰ੍ਹਾਂ ਦੇ ਵੀ ਬੱਚਿਆਂ ਦੇ ਤੁਹਾਨੂੰ ਸ਼ੂਜ਼ ਚਾਹੀਦੇ ਹੋਏ ਸਪੋਰਟਸ ਸ਼ੂਜ ਜਾਂ ਕੈਜੂਅਲ ਸ਼ੂਜ਼ ਤੇ ਜੋ ਵੀ ਕੁਰਤੇ ਪਜਾਮੇ ਨਾਲ ਪਾਉਣ ਵਾਲੇ ਕੋਟ ਪੈਂਟ ਨਾਲ ਪਾਉਣ ਵਾਲੇ ਚਿਕਨ ਸੂਟ ਨਾਲ ਪਾਉਣ ਵਾਲੇ ਸਾਰੇ ਤਰ੍ਹਾਂ ਦੇ ਆਪਣੇ ਕੋਲ ਮਿਲ ਜਾਣਗੇ ਜੀ ਹਾਂਜੀ ਹਾਂਜੀ ਠੀਕ ਹ ਹਾਂ ਜਦੋਂ ਮਰਜ਼ੀ ਆਓ ਜੀ ਮੋਸਟ ਵੈਲਕਮ